ਪੰਜਾਬ ਵਿੱਚ ਕਈ ਤਰ੍ਹਾਂ ਦੀ ਚਿੱਤਰਕਾਰੀ ਕੀਤੀ ਜਾਂਦੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਹੈ ਕਈ ਲੋਕ ਹੱਥਾਂ ਨਾਲ ਪੇਪਰਾਂ 'ਤੇ ਕਲਾਕਾਰੀ ਕਰਦੇ ਹਨ ਅਤੇ ਕਈ ਪੱਥਰਾਂ 'ਤੇ ਕਰਦੇ ਹਨ ਮੈਂ ਜਿਸ ਚੀਜ਼ ਬਾਰੇ ਗੱਲ ਕਰ ਰਹੀ ਹਾਂ ਉਹ ਹੈ ਪੱਥਰਾਂ ਦੀ ਚਿੱਤਰਕਾਰੀ ਜਿਸ ਨੂੰ ਅਸੀਂ ਰੋਕ ਆਰਟ ਵੀ ਕਹਿੰਦੇ ਹਾਂ ਪੱਥਰਾਂ 'ਤੇ ਕੀਤੀ ਚਿੱਤਰਕਾਰੀ ਬਹੁਤ ਹੀ ਸੋਹਣੀ ਅਤੇ ਖੁਸ਼ਮਈ ਲੱਗਦੀ ਹੈ ਜਿਸ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਅਤੇ ਲੋਕ ਬਹੁਤ ਹੀ ਦੇਖਣ ਆਉਂਦੇ ਹਨ ਇਸ ਦੀ ਇੱਕ ਬਹੁਤ ਹੀ ਮਜ਼ੇਦਾਰ ਉਦਾਹਰਨ ਹੈ ਰੋਕ ਗਾਰਡਨ ਚੰਡੀਗੜ੍ਹ ਜਿਸ 'ਤੇ ਸਾਰੀ ਕਲਾਕਾਰੀ ਚਿੱਤਰਕਾਰੀ ਪੱਥਰਾਂ ਉੱਤੇ ਹੀ ਕੀਤੀ ਗਈ ਹੈ ਪੱਥਰਾਂ 'ਤੇ ਹਾਥੀ ਪੱਥਰਾਂ ਦੀ ਗੁਫਾ ਪੱਥਰਾਂਂ ਦੇ ਝਰਨੇ ਪੱਥਰਾਂ ਦੀਆਂ ਪੌੜੀਆਂ ਆਦਿ ਜੋ ਕਿ ਦੇਖਣ ਨੂੰ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ ਜਿਸ ਨੂੰ ਦੇਖ ਕੇ ਆਨੰਦ ਆ ਜਾਂਦਾ ਹੈ ਅਤੇ ਜਿਸ ਨੂੰ ਦੇਖ ਕੇ ਲੋਕ ਬਹੁਤ ਖੁਸ਼ ਹੋ ਜਾਂਦੇ ਹਨ ਉਹਨਾਂ ਪੱਥਰਾਂ 'ਚ ਵੱਖਰਾ ਵੱਖਰਾ ਰੰਗ ਭਰਿਆ ਹੁੰਦਾ ਹੈ